ਮੈਨੂੰ ਪਾਲਤੂ ਜਾਨਵਰ ਬਿਲਕੁਲ ਨਹੀਂ ਪਸੰਦ ਕਿਉਂਕਿ ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਮੈਨੂੰ ਕੀ ਆ ਇੱਕ ਕੁੱਤੇ ਨੇ ਕੀ ਆ ਵੱਢ ਲਿਆ ਸੀ ਉਸ ਤੋਂ ਬਾਅਦ ਮੈਨੂੰ ਬੜਾ ਹੀ ਡਰ ਲੱਗਣ ਲੱਗ ਗਿਆ ਕਿ ਮੈਂ ਪਾਲਤੂ ਜਾਨਵਰ ਮਤਲਬ ਨਾ ਤਾਂ ਕਦੇ ਰੱਖਿਆ ਅਤੇ ਨਾ ਹੀ ਮਤਲਬ ਘਰੇ ਵੀ ਨਹੀਂ ਹੈਗਾ ਸਾਡੇ ਅਤੇ ਜੇ ਮਤਲਬ ਮੈਨੂੰ ਬੜਾ ਡਰ ਲੱਗਦਾ ਬਿੱਲੀਆਂ ਮੈਨੂੰ ਦੂਰੋਂ ਬਹੁਤ ਪਸੰਦ ਆ ਵੈਸੇ ਤਾਂ ਮੈਨੂੰ ਡੋਗੀਸ ਵੀ ਬਹੁਤ ਮਤਲਬ ਦੂਰੋਂ ਪਸੰਦ ਆ ਪਰ ਮੈਂ ਰੱਖ ਨਹੀਂ ਸਕਦੀ ਉਹਨਾਂ ਨੂੰ ਆਪਣੇ ਕੋਲ ਅਤੇ ਇਸ ਲਈ ਕੀ ਹੈ ਮੈਂ ਮਤਲਬ ਕਦੇ ਜਾਨਵਰ ਰੱਖਿਆ ਨਹੀਂ ਹੁਣ ਜਦ ਮਤਲਬ ਅਸੀਂ ਆਪਣੇ ਘਰ ਦੇ ਵਿੱਚ ਮੱਝਾਂ ਰੱਖੀਆਂ ਹੋਈਆਂ ਨੇ ਜਿਨ੍ਹਾਂ ਤੋਂ ਸਾਨੂੰ ਦੁੱਧ ਵਗੈਰਾ ਮਿਲਦਾ ਹੈ ਹਾਂ ਉਹ ਵਧੀਆ ਲੱਗਦੇ ਉਹ ਮਾਰਦੇ ਵੀ ਨਹੀਂ ਅਤੇ ਉਹਨਾਂ ਨੂੰ ਅਸੀਂ ਮਤਲਬ ਘਰ ਰੱਖਦੇ ਹਾਂ ਵਧੀਆ ਢੰਗ ਨਾਲ ਅਤੇ ਉਹ ਰਹਿੰਦੇ ਆ ਬਾਕੀ ਮੈਨੂੰ ਪਾਲਤੂ ਜਾਨਵਰ ਵੈਸੇ ਮੇਰਾ ਕੋਈ ਮੈਨੂੰ ਮਤਲਬ ਇੱਦਾਂ ਪਸੰਦ ਨਹੀਂ ਹੈ ਹਾਂ ਦੂਰੋ ਠੀਕ ਹੈ ਦੇਖ ਕੇ ਹਰੇਕ ਦੀ ਮਤਲਬ ਉਹ ਕਰਦੀ ਹਾਂ ਪਰ ਮੈਨੂੰ ਮਤਲਬ ਮੈਂ ਕਦੇ ਰੱਖਿਆ ਨਹੀਂ